ਹਾਂਜੀ ਸਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਸੱਭਿਆਚਾਰਕ ਮੇਲੇ ਮੇਲੇ ਤਾਂ ਸਰ ਇੱਦਾਂ ਵੀ ਤਕਰੀਬਨ ਹੁਣ ਛਿੰਝ ਮੇਲੇ ਜਿਹੜੇ ਨਾ ਆਮ ਹੀ ਪਿੰਡਾਂ 'ਚ ਹੁੰਦੇ ਜੇ ਸੌ ਪਿੰਡ ਹੈ ਤਾਂ ਪੱਚੀ ਤੀਹ ਪਿੰਡਾਂ 'ਚ ਆਮ ਏ ਛਿੰਝ ਮੇਲੇ ਕਰਵਾਉਂਦੇ ਲੋਕ ਬੜਾ ਉਤਸ਼ਾਹ ਆ ਲੋਕਾਂ 'ਚ ਅਤੇ ਇਸ ਤੋਂ ਇਲਾਵਾ ਸਾਡੇ ਇਲਾਕੇ ਦਾ ਜਿੱਦਾਂ ਇੱਕ ਦੀਵਾਲੀ ਤੋਂ ਦੂਜੇ ਦਿਨ ਹੁੰਦਾ ਵਿਸ਼ਕਰਮਾ ਡੇ ਔਰ ਬਾਬਾ ਬਲਰਾਜ ਦਿਵਸ ਮਨਾਉਂਦੇ ਆ ਇੱਥੇ ਬੜੀ ਤਕੜੀ ਛਿੰਝ ਹੁੰਦੀ ਹੈ ਜੀ ਮੇਲਾ ਅਤੇ ਜਿੱਦਾਂ ਹੁਣ ਉਹ ਤਾਂ ਹੁਣ ਟਾਈਮ ਲੰਘ ਗਿਆ ਵਾ ਜੇ ਤਾਂ ਕਵਰੇਜ ਲਈ ਤੁਸੀਂ ਕਹਿੰਦੇ ਤਾਂ ਇੱਕ ਇੱਥੇ ਸਾਡੇ ਪਿੰਡ ਹੀ ਹੈ ਧੌਲ ਵਿਖੇ ਬਾਬਾ ਜੋਗੀ ਪੀਰ ਜੀ ਦਾ ਸਥਾਨ ਹੈ ਜੀ ਅਤੇ ਬਹੁਤ ਪੁਰਾਤਨ ਸਮੇਂ ਤੋਂ ਉੱਥੇ ਮਾਘੀ ਦਾ ਮੇਲਾ ਮਨਾਉਂਦੇ ਆ ਜੀ ਚੌਦ੍ਹਾਂ ਜਨਵਰੀ ਨੂੰ ਅਤੇ ਬੜੇ ਬੜੇ ਨਾਮਵਾਰ ਕਲਾਕਾਰ ਵੀ ਆਉਂਦੇ ਆ ਜੀ ਅਤੇ ਸੰਗਰਾਂਦ ਵਾਲੇ ਦਿਨ ਅਤੇ ਉਹ ਤੁਸੀਂ ਕਵਰੇਜ ਕਰ ਸਕਦੇ ਆ ਜੇ ਤੁਸੀਂ ਚਾਹੋ ਹਾਂ ਹਾਂ ਇਹ ਪ੍ਰਵਾਨਿਤ ਮੇਲਿਆਂ 'ਚੋਂ ਇੱਕ ਮੇਲਾ ਜੀ ਕ ਘੱਟ ਤੋਂ ਘੱਟ ਮੇਰੇ ਖਿਆਲ ਇਲਾਕੇ ਦੇ ਹੀ ਆਉਂਦੇ ਆ ਜੀ ਦਸ ਪੰਦਰਾਂ ਪਿੰਡਾਂ ਦੇ ਲੋਕ ਇੱਥੇ ਬਹੁਤ ਵੱਡਾ ਇਕੱਠ ਹੁੰਦਾ ਜੀ ਹਾਂਜੀ ਅਤੇ ਉਹ ਤੁਸੀਂ ਦੱਸ ਦਿਓ ਆਪਾਂ ਉਸ ਹਿਸਾਬ ਨਾਲ਼ ਤੁਹਾਡਾ ਵੀ ਫਿਰ ਪ੍ਰਬੰਧ ਕਰ ਦੇਵਾਂਗੇ ਜੀ ਕਵਰੇਜ ਨੂੰ ਆ ਜਿਓ ਜੀ ਆਇਆਂ ਨੂੰ ਜੀ ਹਾਂ ਚੌਦ੍ਹਾਂ ਨੂੰ ਆ ਜਿਓ ਮੇਲਾ ਅਤੇ ਉੱਦਾਂ ਗਿਆਰ੍ਹਾਂ ਤੋਂ ਸ਼ੁਰੂ ਹੋ ਜਾਂਦਾ ਜੀ ਇਹ ਪਰ ਅਸਲ ਫਾਈਨਲ ਡੇ ਜਿਹੜਾ ਹੈਗਾ ਉਹ ਚੌਦ੍ਹਾਂ ਜਨਵਰੀ ਦਾ ਹੀ ਹੈ ਜੀ

ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਚੌਦ੍ਹਾਂ ਜਨਵਰੀ ਨੂੰ ਹਾਂਜੀ ਕੋਈ ਗੱਲ ਏ ਨਹੀਂ ਸਰ ਬਹੁਤ ਬਹੁਤ ਮੋਸਟ ਵੈਲਕਮ ਜੀ ਠੀਕ ਠੀਕ ਹੈ ਸਰ ਮੇਹਰਬਾਨੀ ਸਤਿ ਸ਼੍ਰੀ ਅਕਾਲ ਜੀ